ਭੰਗੜਾ ਐਰੋਬਿਕਸ ਵਿੱਚ ਹਿੱਸਾ ਲੈਣ ਨਾਲ ਸਰੀਰਕ ਅਤੇ ਮਾਨਸਿਕ ਤੌਰ 'ਤੇ ਆਪਾਂ ਕੁਝ ਇਸ ਤਰ੍ਹਾਂ ਮਹਿਸੂਸ ਕਰਦੇ ਜਿਵੇਂ ਕਿ ਭੰਗੜਾ ਐਰੋਬਿਕਸ ਇੱਕ ਵਰਕਆਊਟ ਵਾਲੀ ਐਕਟੀਵਿਟੀ ਹੈ ਇਕ ਹਾਈਲੀ ਐਨਜਰਟਿਕ ਜਿਹਦੇ ਵਿੱਚ ਮੂਮੈਂਟਸ ਇਨਵੋਲਵਡ ਹੁੰਦੇ ਆ ਇਹਦੇ ਨਾਲ ਆਪਣੀ ਕਿ ਕੈਲੋਰੀਜ ਬਰਨਸ ਹੋ ਸਕਦੀਆਂ ਸੋਮਾ ਫਿਟ ਰਹਿ ਸਕਦੇ ਹਾਂ ਮਾਨਸਿਕ ਤੌਰ 'ਤੇ ਜੇ ਗੱਲ ਕਰੀਏ ਤਾਂ ਆਪਣੇ ਜ਼ਿੰਦਗੀ ਆਮ ਜ਼ਿੰਦਗੀ ਵਿਚ ਕੁਝ ਨਾ ਕੁਝ ਦਿੱਕਤਾਂ ਹਰੇਕ ਨੂੰ ਹੀ ਹੁੰਦੀਆਂ ਅਤੇ ਥੋੜ੍ਹਾ ਬਹੁਤ ਮਾਈਡ ਨੂੰ ਰੀਲੈਕਸ ਕਰਨ ਲਈ ਭੰਗੜਾ ਐਰੋਬਿਕਸ ਦੀ ਮਦਦ ਨਾਲ ਆਪਾਂ ਉਸ ਚੀਜ਼ ਨੂੰ ਇੰਜੋਏ ਕਰਕੇ ਥੋੜ੍ਹੀ ਦੇਰ ਆਪਣੇ ਸਟ੍ਰੈਸ ਨੂੰ ਦੂਰ ਕਰ ਸਕਦੇ ਹਾਂ ਹੁਣ ਜੇ ਆਪਾਂ ਫਿਜੀਕਲ ਏਸਪੇਕਟ ਦੀ ਗੱਲ ਕਰੀਏ ਤਾਂ ਭੰਗੜਾ ਇੱਕ ਹਰਟ ਲਈ ਹੈਲਥੀ ਐਕਸਰਸਾਈਜ ਹੈ ਜਿਹੜੀ ਕਿ ਆਪਣੀ ਬਾਹਵਾਂ ਹਿਪਸ ਲੈਗਸ ਨੂੰ ਟੋਨ ਕਰਨ ਵਿੱਚ ਮਦਦ ਕਰਦੇ ਅਤੇ ਆਪਣੀ ਪੋਸਟਿਕ ਆਪਣੀ ਬਣਤਰ ਜਿਹੜੀ ਸਰੀਰ ਦੀ ਬਣਤਰ ਠੀਕ ਹੈ ਕਿਵੇਂ ਖੜਨਾ ਹੈ ਬੈਲੈਂਸ ਬਣਾਉਣ 'ਚ ਵੀ ਕਾਫੀ ਮਦਦ ਕਰਦੀ ਜੇਕਰ ਆਪਾਂ ਪੰਤਾਲੀ ਮਿੰਟ ਦਾ ਸੈਸ਼ਨ ਲਾਨੇ ਹਾਂ ਭੰਗੜਾ ਐਰੋਬਿਕਸ ਦਾ ਅਤੇ ਉਹਦੇ ਵਿੱਚ ਆਪਣੀਆਂ ਪੰਜ ਸੌ ਕੈਲੋਰੀਜ ਬਰਨ ਹੋ ਸਕਦੀਆਂ ਜੇ ਮੈਂਟਲ ਐਸਪੈਕਟ ਦੀ ਗੱਲ ਕਰੀਏ ਤਾਂ ਭੰਗੜਾ ਕਿ ਆਪਣੀ ਜਿਹੜੀਆਂ ਡੇਲੀ ਸਟਰੈਸਸ ਦੀਆਂ ਪ੍ਰੋਬਲਮ ਅਸੀਂ ਫੇਸ ਕਰਦੇ ਹਾਂ ਉਹਨਾਂ ਨੂੰ ਥੋੜ੍ਹਾ ਬਹੁਤ ਉੱਪਰ ਰੱਖ ਕੇ ਆਪਾਂ ਭੰਗੜੇ ਨਾਲ ਆਪਦਾ ਐਟਮੋਸਫੀਅਰ ਥੋੜ੍ਹਾ ਬਹੁਤ ਰਿਲੈਕਸ ਵੀ ਕਰ ਸਕਦੇ ਇਹਦੇ ਨਾਲ ਆਪਣੇ ਕਿ ਕੌਨਫੀਡੈਂਸ ਵਿੱਚ ਵੀ ਇਮਪਰੂਵਮੈਂਟ ਆਉਂਦਾ ਹੈ ਠੀਕ ਹੈ ਨਾਸ ਦੇ ਹੋਰ ਵੀ ਬੈਨੀਫਿਟਸ ਹੈਗੇ ਹੈ ਜਿਵੇਂ ਕਿ ਆਪਣੀ ਹਰਟ ਲੰਗਜ਼ ਦੀ ਕੰਡੀਸ਼ਨ ਵੀ ਥੋੜ੍ਹੀ ਬਹੁਤ ਇੰਪਰੂਵਮੈਂਟ ਹੁੰਦੀਆਂ ਮਸਕਲਰ ਸਟਰੈਂਥ ਵਿੱਚ ਵਾਧਾ ਹੁੰਦਾ ਠੀਕ ਹੈ ਆਪਣੀ ਸਲੀਪ ਵਿੱਚ ਵੀ ਥੋੜ੍ਹੀ ਬਹੁਤ ਇੰਪਰੂਵਮੈਂਟ ਤੁਹਾਡੀ ਆਪਣੀ ਸਕਿਲ 'ਚ ਵੀ ਇਮਪਰੂਵਮੈਂਟ ਆਉਂਦੀਆਂ ਠੀਕ ਹੈ ਆਪਾਂ ਜਿਹੜੀ ਓਸਟੀਓਪ੍ਰੋਸੈਸ ਬੋਨਸ ਨਾਲ ਰਿਲੇਟਡ ਜਿਹੜੀ ਇੱਕ ਡਜ਼ੀਜ਼ ਉਹ ਹੈ ਕੰਡੀਸ਼ਨ ਹੈ ਠੀਕ ਹੈ ਉਹਦੇ ਨਾਲ ਉਦੋਂ ਆਪਣਾ ਰਿਸਕ ਵੀ ਘਟਾ ਸਕਦੇ ਹਾਂ ਸੋ ਇਸ ਤਰ੍ਹਾਂ ਭੰਗੜਾ ਐਰੋਬਿਕਸ ਦੇ ਵੀ ਬਹੁਤ ਸਾਰੇ ਫਾਇਦੇ ਹੈ ਜਿਵੇਂ ਕਿ ਇੱਕ ਵਰਕਆਊਟ ਹੈ ਜਿਤਨਾ ਆਪਾਂ ਹਾਈਲੀ ਇਨਰਜੈਟਿਕ ਮੂਵਮੈਂਟਸ ਉਹਦੇ ਨਾਲ ਹੀ ਆਪਾਂ ਫਿਟ ਵੀ ਰਹਿ ਸਕਦੇ ਹਾਂ ਰਿਲੈਕਸ ਵੀ ਰਹਿ ਸਕਦੇ ਹਾਂ